ਸਾਡੇ ਧਾਰਮਿਕ ਤਿਉਹਾਰ ਨਾਲ ਸਬੰਧਿਤ ਖਾਣ ਪੀਣ ਦੀ ਚੀਜ਼ ਮਠਿਆਈ ਹੈ ਕਿਉਂਕਿ ਇਹ ਹੀ ਤਿਉਹਾਰਾਂ ਦੀ ਮੌਕੇ 'ਤੇ ਸਭ ਨੂੰ ਵੰਡੀ ਜਾਂਦੀ ਹੈ